ਸਕੂਲ ਤੋਂ ਬਾਅਦ ਟਿਊਸ਼ਨ ਹੋਣਾ ਬਹੁਤ ਜ਼ਰੂਰੀ ਹੈ ਅਤੇ ਬੱਚੇ ਸਕੂਲ ਤੋਂ ਬਾਅਦ ਟਿਊਸ਼ਨ ਜਾਂਦੇ ਹਨ ਕਈ ਬੱਚਿਆਂ ਦੇ ਮਾਪੇ ਅਨਪੜ੍ਹ ਹੁੰਦੇ ਹਨ ਅਤੇ ਉਹ ਆਪਣੇ ਬੱਚਿਆਂ ਨੂੰ ਟਿਊਸ਼ਨ ਨਹੀਂ ਪੜ੍ਹਾ ਸਕਦੇ ਇਸ ਲਈ ਉਹ ਆਪਣੇ ਬੱਚਿਆਂ ਨੂੰ ਹੁਸ਼ਿਆਰ ਬਣਾਉਣ ਲਈ ਟਿਊਸ਼ਨ ਵਿੱਚ ਪਾ ਦਿੰਦੇ ਹਨ ਬੱਚੇ ਆਪਣੇ ਸਕੂਲ ਟਾਈਮ ਤੋਂ ਬਾਅਦ ਟਿਊਸ਼ਨ 'ਤੇ ਜਾਂਦੇ ਹਨ ਕਈ ਬੱਚਿਆਂ ਦੇ ਮਾਪੇ ਕੋਈ ਜੋਬ ਕਰਦੇ ਹਨ ਅਤੇ ਉਨ੍ਹਾਂ ਕੋਲ ਆਪਣੇ ਬੱਚਿਆਂ ਨੂੰ ਗਾਈਡ ਕਰਨ ਲਈ ਟਾਈਮ ਨਹੀਂ ਹੁੰਦਾ ਇਸ ਲਈ ਉਹ ਆਪਣੇ ਬੱਚਿਆਂ ਨੂੰ ਟਿਊਸ਼ਨ ਪਾ ਦਿੰਦੇ ਹਨ ਟਿਊਸ਼ਨ ਪਾਉਣ ਕਾਰਨ ਬੱਚੇ ਆਪੇ ਬਹੁਤ ਕੁਛ ਸਿੱਖਦੇ ਹਨ ਉਨ੍ਹਾਂ ਦੀ ਜਾਣਕਾਰੀ ਵਿੱਚ ਵਾਧਾ ਹੁੰਦਾ ਹੈ ਇਸ ਨਾਲ ਬੱਚੇ ਦਾ ਪੜ੍ਹਾਈ ਵਿੱਚ ਇੰਟ੍ਰਸਟ ਬਣਦਾ ਹੈ ਟਿਊਸ਼ਨ ਬਹੁਤ ਜ਼ਰੂਰੀ ਹੈ ਹਰ ਇੱਕ ਬੱਚੇ ਲਈ ਟਿਊਸ਼ਨ ਜ਼ਰੂਰੀ ਹੈ ਟਿਊਸ਼ਨ ਇੱਕ ਰੁਜ਼ਗਾਰ ਦਾ ਸਾਧਨ ਵੀ ਹੈ ਜਿਵੇਂ ਬਹੁਤ ਸਾਰੇ ਬੱਚੇ ਪੜ੍ਹੇ ਲਿਖੇ ਹੁੰਦੇ ਹਨ ਪਰ ਉਨ੍ਹਾਂ ਕੋਲ ਕੋਈ ਰੁਜ਼ਗਾਰ ਦਾ ਸਾਧਨ ਨਹੀਂ ਹੈ ਇਸ ਲਈ ਉਹ ਟਿਊਸ਼ਨ ਰਾਹੀਂ ਆਪਣਾ ਜ਼ਰੂਰਤਾਂ ਪੂਰੀਆਂ ਕਰ ਸਕਦੇ ਹਨ ਕਈ ਕੁੜੀਆਂ ਜਿਵੇਂ ਉਹਨਾਂ ਨੂੰ ਉਹਨਾਂ ਦੇ ਘਰਦੇ ਬਾਹਰ ਨਹੀਂ ਭੇਜ ਸਕਦੇ ਇਸ ਲਈ ਉਹ ਘਰ ਬੈਠ ਕੇ ਟਿਊਸ਼ਨ ਪੜ੍ਹਾ ਕੇ ਆਪਣਾ ਰੁਜ਼ਗਾਰ ਚਲਾ ਸਕਦੀਆਂ ਹਨ ਆਪਣਾ ਕੋਈ ਕੰਮ ਕਰ ਸਕਦੀਆਂ ਹਨ ਉਹ ਆਪਣਾ ਖਰਚਾ ਟਿਊਸ਼ਨ ਪੜ੍ਹਾ ਕੇ ਆਪ ਕੱਢ ਲੈਂਦੀਆਂ ਹਨ ਇਸ ਨਾਲ ਉਨ੍ਹਾਂ ਨੂੰ ਵੀ ਹੋਰ ਜਾਣਕਾਰੀ ਪ੍ਰਾਪਤ ਹੁੰਦੀ ਹੈ ਇਸ ਲਈ ਟਿਊਸ਼ਨ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਵਪੂਰਨ ਹੈ